ਸਤਿ ਸ਼੍ਰੀ ਅਕਾਲ ਜੀ ਔਲਾ ਕੈਬਸ ਤੋਂ ਤੇ ਮੈਂ ਇੱਕ ਬੁਕਿੰਗ ਕਰਨੀ ਸੀ ਇੱਕ ਗੱਡੀ ਦੀ ਮੈਨੂੰ ਪਰਸੋਂ ਸਵੇਰੇ ਦਸ ਵਜੇ ਇੱਕ ਸੈਵਨ ਸੀਟਰ ਗੱਡੀ ਚਾਹੀਦੀ ਹੈ ਅਤੇ ਮੈਂ ਆਪਣੇ ਸ਼ਹਿਰ ਤੋਂ ਬਠਿੰਡੇ ਤੋਂ ਅਤੇ ਮੇਰਾ ਘਰ ਹੈ ਆਦਰਸ਼ ਕਲੋਨੀ ਵਿੱਚ ਅਤੇ ਆਦਰਸ਼ ਕਲੋਨੀ ਵਿੱਚ ਮੇਰਾ ਅਪਾਰਟਮੈਂਟ ਹੈ ਆਦਰਸ ਕਲੋਨੀ 'ਚ ਤੁਹਾਡੇ ਡਰਾਈਵਰ ਨੂੰ ਭੇਜਣਾ ਅਤੇ ਮੈਨੂੰ ਉੱਥੋਂ ਪਿਕ ਅੱਪ ਕਰਨਾ ਉਸ ਤਰੀਕ ਨੂੰ ਪਰਸੋਂ ਮੈਨੂੰ ਪਿਕ ਅੱਪ ਕਰਨਾ ਸੁਬਾ ਦਸ ਵਜੇ ਅਤੇ ਮੈਨੂੰ ਇੱਕ ਸੈਵਨ ਸੀਟਰ ਗੱਡੀ ਚਾਹੀਦੀ ਹੈ ਅਤੇ ਮੈਂ ਬਠਿੰਡੇ ਤੋਂ ਲਾ ਲਾਗੇ ਦੇ ਸ਼ਹਿਰ ਸਰਸੇ ਵਿੱਚ ਜਾਣਾ ਅਤੇ ਮੈਨੂੰ ਉੱਥੇ ਕੋ ਸੱਤ ਛੇ ਪੰਜ ਛੇ ਘੰਟਿਆਂ ਦਾ ਕੰਮ ਹੈ ਅਤੇ ਪੰਜ ਛੇ ਘੰਟੇ ਮੈਂ ਉੱਥੇ ਸਪੈਂਡ ਕਰਨੇ ਆ ਅਤੇ ਮੈਨੂੰ ਕੋਈ ਇਹੋ ਜਿਹਾ ਡਰਾਈਵਰ ਚਾਹੀਦਾ ਹੈ ਜਿਹੜਾ ਐਕਸਪੀਰੀਅੰਸਡ ਹੋਵੇ ਅਤੇ ਜਿਹੜਾ ਥੋੜ੍ਹਾ ਪੇਸ਼ੈਂਟਸ ਹੋਵੇ ਉੱਥੇ ਜਾ ਕੇ ਮੈਨੂੰ ਕਾਫੀ ਰਿਲੇਟਿਵ 'ਚ ਰਿਲੇਸ਼ਨ 'ਚ ਵੀ ਕੰਮ ਹੈ ਅਤੇ ਉੱਥੇ ਮੈਨੂੰ ਥੋੜ੍ਹਾ ਬਹੁਤਾ ਆਸੇ ਆਲੇ ਦੁਆਲੇ ਘੁੰਮਣਾ ਵੀ ਆ ਉਹਦਾ ਜੇ ਕੋਈ ਐਕਸਟਰਾ ਚਾਰਜ ਬਣਦਾ ਤਾਂ ਮੈਂ ਤੁਹਾਨੂੰ ਦੇਣ ਲਈ ਤਿਆਰ ਹਾਂ ਅਤੇ ਮੇਰੇ ਪਰਿਵਾਰ ਵਿੱਚ ਸੱਤ ਜਣੇ ਹੈ ਅਤੇ ਗੱਡੀ ਐਸ ਯੂ ਵੀ ਹੋਵੇ ਜਿਹਦੇ ਵਿੱਚ ਲੈਗ ਸਪੇਸ ਹੋਵੇ ਅਤੇ ਕਿਉਂਕਿ ਜਿਹੜੇ ਸਾਡੇ ਬੰਦੇ ਹੈ ਉਹ ਲੰਬੇ ਹੈ ਅਤੇ ਲੈਗ ਸਪੇਸ ਤਾਂ ਹੋਵੇ ਅਤੇ ਹੈਡ ਸਪੇਸ ਹੋਵੇ ਅਤੇ ਗੱਡੀ ਸਾਨੂੰ ਸੈਵਨ ਸੀਟਰ ਚਾਹੀਦੀ ਹੈ ਗੱਡੀ ਸੈਵਨ ਸੀਟਰ ਹੋਵੇ ਅਤੇ ਕੰਫਰਟੇਬਲ ਹੋਵੇ ਸਾਨੂੰ ਸਵੇਰੇ ਦਸ ਵਜੇ ਡਰਾਈਵਰ ਆ ਜਾਵੇ ਟਾਈਮ 'ਚ ਸਾਨੂੰ ਪਿਕ ਅੱਪ ਕਰੇ ਅਤੇ ਸਾਨੂੰ ਛੇ ਜਾਂ ਸੱਤ ਘੰਟਿਆਂ ਤੱਕ ਉਹ ਗੱਡੀ ਸਾਡੀ ਤੁਹਾਡੀ ਚਾਹੀਦੀ ਹੈ ਅਤੇ ਜਿੰਨਾ ਵੀ ਹੋ ਸਕੇ ਤੁਸੀਂ ਕੋਈ ਐਕਸਪੀਰੀਅੰਸ ਡਰਾਈਵਰ ਜਾਂ ਫਿਰ ਇਹੋ ਜਿਹਾ ਡਰਾਈਵਰ ਜਿਹਦੀ ਰੇਟਿੰਗਸ ਕਾਫੀ ਅੱਛੀ ਹੋਵੇ ਜਾਂ ਇਹੋ ਜਿਹੀ ਗੱਡੀ ਜਿਹੜੀ ਕੰਫਰਟੇਬਲ ਹੋਵੇ ਟਰੈਵਲ ਵਿੱਚ ਕਿਉਂਕਿ ਹੁਣ ਸਮਰ ਦਾ ਪੀਕ ਮੰਥ ਹੈ ਸਾਨੂੰ ਏ ਸੀ ਵਾਲੀ ਗੱਡੀ ਹੀ ਚਾਹੀਦੀ ਹੈ ਤਾਂ ਕੀ ਜੋ ਅਸੀਂ ਸਾਡਾ ਜਿਹੜਾ ਸਾਡਾ ਸਾਰਾ ਸਫਰ ਹੈ ਉਹਨੂੰ ਸਹੀ ਤਰੀਕੇ ਨਾਲ ਅਤੇ ਕੰਫਰਟੇਬਲੀ ਜਾ ਸਕੀਏ ਅਤੇ ਸੈਵਨ ਸੀਟਰ ਐਸ ਯੂ ਵੀ ਜਿਹੜੀ ਵੀ ਤੁਹਾਨੂੰ ਫਿੱਟ ਲੱਗਦੀ ਹੋਏ ਉਹ ਮੈਨੂੰ ਪਰਸੋਂ ਸਵੇਰੇ ਦਸ ਵਜੇ ਆਦਰਸ਼ ਕਲੋਨੀ ਬਠਿੰਡੇ ਵਿੱਚ ਮੇਰੇ ਘਰ ਦੇ ਸਾਹਮਣੇ ਚਾਹੀਦੀ ਹੈ